ਹੈਲੋ ਹਾਂਜੀ ਹਾਂਜੀ ਅਮਨ ਭਾਅ ਜੀ ਬੋਲਦੇ ਪਏ ਹਾਂਜੀ ਓ ਮਹਾਰਾਜ ਕੀ ਹਾਲ ਚਾਲ ਨੇ ਕਿੱਥੇ ਰਹਿੰਦੇ ਅੱਜ ਕੱਲ੍ਹ ਹਾਂਜੀ ਪਛਾਣਿਆ ਹਾਂਜੀ ਹਾਂਜੀ ਪ੍ਰਿੰਸ ਬੋਲਦਾ ਪਿਆ ਮੈਂ ਹਾਂਜੀ ਹਾਂਜੀ ਹਾਂਜੀ ਮਹਾਰਾਜ ਛ ਛੋਟਾ ਕੰਮ ਪੈ ਗਿਆ ਤੁਹਾਡੇ ਨਾਲ ਇੱਕ ਆਪਾਂ ਨਾ ਐਕਚੁਲੀ ਕਿਤੇ ਜਾਣਾ ਸੀ ਅਤੇ ਆਪਾਂ ਕੈਬ ਬੁੱਕ ਕਰਨੀ ਸੀ ਤੁਹਾਡੇ ਕੋਲੋਂ ਇੱਕ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਲੈ ਕੇ ਹਿਮਾਚਲ ਤੱਕ ਜਾਣਾ ਸੀ ਆਪਾਂ ਹਾਂਜੀ ਅਤੇ ਤੁਹਾਡੇ ਕੋਲ ਇੱਕ ਸਲਾਹ ਲੈਣੀ ਆ ਆਪਾਂ ਕਿ ਆਪਾਂ ਕਿਹੜੀ ਕੈਬ ਬੁੱਕ ਕਰੀਏ ਮਤਲਬ ਛੋਟੀ ਗੱਡੀ ਹੋਵੇ ਉਹਦੇ ਵਿੱਚ ਚਾਰ ਜਣੇ ਆਪਾਂ ਹੈਗੇ ਜੋ ਜਿਹੜੇ ਆਰਾਮ ਨਾਲ ਬਹਿ ਸਕੀਏ ਅਤੇ ਸਾਡੇ ਕੋਲ ਸਮਾਨ ਵੀ ਕੁਝ ਜ਼ਿਆਦਾ ਨਹੀਂ ਹੈਗਾ ਦੋ ਤਿੰਨ ਬੈਗ ਹੀ ਹੈਗੇ ਆ ਹਾਂਜੀ ਛੋਟੀ ਗੱਡੀ ਹੋਵੇ ਸਸਤੀ ਹੋਵੇ ਅਤੇ ਵਧੀਆ ਹੋਵੇ ਅਤੇ ਕੰਫਰਟੇਬਲ ਹੋਵੇ ਮੈਂ ਮੇਰੀ ਵਾਈਫ ਅਤੇ ਮੇਰੇ ਬੱਚੇ ਹੈਗੇ ਜੋ ਹਾਂਜੀ ਆਪਾਂ ਚਾਰ ਜਣਿਆ ਨੇ ਜਾਣਾ ਵਾ ਅਤੇ ਮਹਾਰਾਜ ਕੋਈ ਆਪਣਾ ਬੰਦਾ ਵੀ ਕੋਈ ਵਧੀਆ ਇਮਾਨਦਾਰ ਭੇਜਿਓ ਜਿਹੜਾ ਸਾਨੂੰ ਲੈ ਚ ਪੂਰੀ ਆਰਾਮ ਨਾਲ ਲੈ ਕੇ ਜਾ ਸਕੇ ਹਾਂਜੀ ਅਤੇ ਸਾਨੂੰ ਕੋਈ ਗੱਡੀ ਸੁਜੈਸਟ ਕਰ ਦਿਉ ਕਿਹੜੀ ਗੱਡੀ ਲੈ ਕੇ ਜਾਈਏ ਆਪਾਂ ਮਰੂਤੀ ਹਾਂਜੀ ਹਾਂਜੀ ਹਾਂਜੀ ਮਰੂਤੀ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਹਾਂਜੀ ਮਤਲਬ ਉੱਥੇ ਸਾਰੇ ਫਿੱਟ ਵੀ ਆ ਜਾਣਗੇ ਮਤਲਬ ਉਹਦਾ ਏ ਸੀ ਉਸੀ ਗੱਡੀ ਗੁੱਡੀ ਦਾ ਨਾ ਮਤਲਬ ਹੀਟਰ ਹੀਟਰ ਦੀ ਸੋਰੀ ਮੈਂ ਕਹਿਣਾ ਸੀ ਹੀਟਰ ਵੀ ਚੱਲਦਾ ਹੋਵੇਗਾ ਤੁਹਾਨੂੰ ਪਤਾ ਅੱਜ ਕੱਲ੍ਹ ਸਿਆਲ ਸਿਆਲੀ ਮੌਸਮ ਹੈਗੇ ਆ ਬੱਚਿਆਂ ਨੂੰ ਠੰਡ ਜਲਦੀ ਲੱਗ ਜਾਂਦੀ ਆ ਸਫ਼ਰ ਵਿੱਚ ਹਵਾ ਪੈ ਜਾਂਦੀ ਆ ਹਾਂਜੀ ਉਹਦੇ ਬਲੋਅਰ ਚੱਲਦਾ ਪਿਆ ਹੋਵੇ ਵਧੀਆ ਹਾਂਜੀ ਹਾਂਜੀ ਪੂਰਾ ਵਧੀਆ ਦੱਸਿਓ ਅਤੇ ਸਾਨੂੰ ਮੈਨੂੰ ਰੇਟ ਵੀ ਦੱਸ ਦਿਉ ਗੱਡੀ ਦਾ ਕੀ ਰੇਟ ਹੈਗਾ ਕੀ ਚਾਰਜ ਲਓਗੇ ਤੁਸੀਂ ਨਹੀਂ ਨਹੀਂ ਭਾਅ ਜੀ ਅੱਠ ਹਜ਼ਾਰ ਤਾਂ ਜ਼ਿਆਦਾ ਹੋ ਜਾਣਾ ਥੋੜ੍ਹਾ ਜਿਹਾ ਅਸੀਂ ਮਤਲਬ ਤੁਹਾਡੇ ਇੰਨੇ ਪੁਰਾਣੇ ਕਸਟਮਰ ਹੈਗੇ ਆ ਤੁਹਾਡੇ ਨਾਲ ਹਾਂਜੀ ਤੁਹਾਨੂੰ ਕਸਟਮਰ ਵੀ ਤੁਹਾਡੇ ਨਾਲ ਮਤਲਬ ਘੱਲਦੇ ਹੁੰਦੇ ਹਾਂ ਆਪਾਂ ਗਵਾਂਢ ਵੀ ਤਾਂ ਸਾਰਾ ਤੁਹਾਡੇ ਵਿੱਚ ਤੁਹਾਡੇ ਵੱਲ ਹੀ ਜਾਂਦਾ ਹਾਂਜੀ ਅਤੇ ਤੁਸੀਂ ਪੈਂਹਟ ਸੌ ਲਓ ਪੈਂਹਠ ਸੌ 'ਚ ਗੱਲ ਮੁਕਾਓ ਹੁਣ ਮਹਾਰਾਜ ਹਾਂਜੀ ਨਹੀਂ ਨਹੀਂ ਪੰਝੱਤਰ ਸੌ ਭਾਅ ਜੀ ਥੋੜ੍ਹਾ ਬਹੁਤਾ ਤੁਸੀਂ ਇੰਨਾ ਵੀ ਨਹੀਂ ਕਰੋਂਗੇ ਸਾਡੇ ਵਾਸਤੇ ਹੁਣ ਦੱਸ ਹਾਂਜੀ ਥੋੜ੍ਹਾ ਬਹੁਤਾ ਕਰੋ ਥੋੜ੍ਹਾ ਘੱਟ ਵੱਧ ਕਰੀਦਾ ਹੁੰਦਾ ਹਾਂਜੀ ਚਲੋ ਠੀਕ ਹੈ ਸੱਤ ਹਜ਼ਾਰ ਠੀਕ ਹੈ ਮਹਾਰਾਜ ਚਲੋ ਤੁਹਾਡੀ ਮੰਨ ਲੈਂਦੇ ਹਾਂ ਸੱਤ ਹਜ਼ਾਰ 'ਚ ਡਨ ਠੀਕ ਆ ਭਾਅ ਜੀ ਐਨ ਪੂਰੀ ਮਤਲਬ ਫਰੈਸ਼ ਕਰਕੇ ਭੇਜਿਓ ਗੱਡੀ ਪੂਰੀ ਧਵਾ ਧਵਾ ਕੇ ਭੇਜਿਓ ਠੀਕ ਹੈ ਹਾਂਜੀ ਸਵੇਰੇ ਨੌ ਵਜੇ ਤੱਕ ਭੇਜ ਦਿਓ ਸਾਡੇ ਵੱਲ ਅੰਮ੍ਰਿਤਸਰ ਤੁਹਾਨੂੰ ਲੋਕੇਸ਼ਨ ਤਾਂ ਮੇਰੀ ਪਤਾ ਹੀ ਹੈ ਕਿੱਥੇ ਹੈ ਆਪਾਂ ਜਾਣਦੇ ਹਾਂ ਇੱਕ ਦੂਜੇ ਨੂੰ ਬਹੁਤ ਚਿਰ ਪੁਰਾਣੇ ਚਿਰ ਤੋਂ ਹਾਂਜੀ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਅਤੇ ਨੌ ਵਜੇ ਤੱਕ ਮਤਲਬ ਰੈਡੀ ਰਿਹੋ ਠੀਕ ਆ ਰੈਡੀ ਰਿਹੋ ਸਾਡੇ ਮੋੜ 'ਤੇ ਆ ਜਿਓ ਮੈਨੂੰ ਕੋਲ ਕਰ ਲਿਓ ਮੈਂ ਤੁਹਾਨੂੰ ਉਸੇ ਵੇਲੇ ਆ ਜਾਂਗਾ ਠੀਕ ਆ ਚਲੋ ਸਤਿ ਸ਼੍ਰੀ ਅਕਾਲ ਭਾਅ ਜੀ